ਰੂਪਨਗਰ ਜ਼ਿਲ੍ਹੇ ਵਿੱਚ ਬਹੁਤ ਹੀ ਅਲੱਗ ਭਾਸ਼ਾਵਾਂ ਪਾਈਆਂ ਜਾਂਦੀਆਂ ਹਨ ਗੱਲ ਕਰ ਲਈਏ ਹਿੰਦੀ ਤੇਲਗੂ ਗੁਜਰਾਤੀ ਯੂਪੀ ਸਾਈਡ ਤੋਂ ਜੋ ਵੀ ਲੋਕ ਇੱਥੇ ਆ ਕੇ ਰਹਿਣ ਲੱਗੇ ਨੇ ਉਹਨਾਂ ਨੇ ਬਹੁਤ ਹੀ ਸਾਡੀ ਭਾਸ਼ਾ ਨੂੰ ਬੋਲੀ ਨੂੰ ਪੰਜਾਬੀ ਬੋਲੀ ਨੂੰ ਪ੍ਰਭਾਵਿਤ ਕੀਤਾ ਹੈ ਕਿਉਂਕਿ ਗੱਲ ਕਰੀਏ ਅੱਜ ਦੇ ਟਾਈਮ ਵਿੱਚ ਜਿਵੇਂ ਦੇਖਿਆ ਜਾਵੇ ਤਾਂ ਬਹੁਤ ਹੀ ਪ੍ਰਵਾਸੀ ਮਜ਼ਦੂਰ ਇੱਥੇ ਆ ਕੇ ਰਹਿਣ ਲੱਗੇ ਨੇ ਉਹਨਾਂ ਦੇ ਆਪਣੇ ਆਪਣੇ ਅਲੱਗ ਅਲੱਗ ਧਰਮ ਨੇ ਹਰੇਕ ਆਪਣੇ ਆਪਣੇ ਸੱਭਿਆਚਾਰ ਹੈ ਉਹਨਾਂ ਦਾ ਜੋ ਕਿ ਜਿਸ ਨਾਲ ਕਿ ਸਾਡਾ ਆਲੇ ਦੁਆਲੇ ਦੀ ਭਾਸ਼ਾ 'ਤੇ ਵੀ ਪ੍ਰਭਾਵ ਪਿਆ ਹੈ ਕਿਉਂਕਿ ਜਿਵੇਂ ਕਿ ਜ਼ਿਆਦਾਤਰ ਤਾਦਾਦ ਵਿੱਚ ਉਹ ਆਪਣਾ ਹਿੰਦੀ ਬੋਲਦੇ ਨੇ ਤਾਮਿਲ ਬੋਲਦੇ ਨੇ ਜਾਂ ਗੁਜਰਾਤੀ ਬੋਲਦੇ ਨੇ ਉਸ ਨਾਲ ਕਿ ਸਾਡੀ ਪੰਜਾਬੀ ਭਾਸ਼ਾ ਵੀ ਕਿਤੇ ਨਾ ਕਿਤੇ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਈ ਹੈ